ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਹਾਂਜੀ ਠੀਕ ਆ ਦੀਦੀ ਜੀ ਸਿੰਪਲ ਹੀ ਸੀਊਂ ਦੇਵਾਂਗੇ ਜੀ ਹਾਂਜੀ ਅਸੀਂ ਮਤਲਬ ਤੁਸੀਂ ਨਾਪ ਦੇ ਜਾਣਾ ਅਸੀਂ ਜਲਦੀ ਸੀਊਂ ਦੇਵਾਂਗੇ ਜੀ ਹਾਂਜੀ ਹਾਂਜੀ ਅਤੇ ਤੁਹਾਨੂੰ ਮਤਲਬ ਕਿੰਨੀ ਤਰੀਕ ਨੂੰ ਤੁਹਾਨੂੰ ਚਾਹੀਦਾ ਜੀ ਹਫ਼ਤੇ 'ਚ ਹੀ ਕਰਾਂ ਕੋਈ ਨਹੀਂ ਤੁਸੀਂ ਦੇ ਜਾਣਾ ਹਾਂ ਜੀ ਅਸੀਂ ਦੇ ਦੇਵਾਂਗੇ ਸੂਟ ਜੀ ਅਤੇ ਮਤਲਬ ਤੁਸੀਂ ਕੋਈ ਲੈਸ ਵਗੈਰਾ ਲਗਾਉਣੀ ਜਿਵੇਂ ਤੁਸੀਂ ਆਖੋਗੇ ਅਸੀਂ ਉਵੇਂ ਕਰ ਲਵਾਂਗੇ ਮੈਂ ਕਿਹਾ ਨਹੀਂ ਤੁਸੀਂ ਆਪ ਦੇ ਜੋ ਆਪਦੇ ਮਨ ਪਸੰਦ ਦੀ ਹੈਂ ਹਾਂਜੀ ਹਾਂਜੀ ਨਹੀਂ ਨਹੀਂ ਨਹੀਂ ਨਹੀਂ ਅਸੀਂ ਇੰਜ ਨਹੀਂ ਕਹਿੰਦੇ ਤੁਸੀਂ ਆਪਦੇ ਮਨ ਪਸੰਦ ਵੀ ਲੈ ਆਉਣਾ ਠੀਕ ਹੈ ਜੀ ਹਾਂਜੀ ਹੋਰ ਮਤਲਬ ਜੇ ਤੁਸੀਂ ਹੋਰ ਤੁਸੀਂ ਅਸੀਂ ਵੀ ਹੋਰ ਵੀ ਸੂਟ ਸੀਊਂ ਦੇਵਾਂਗੇ ਜੇ ਤੁਸੀਂ ਆਖੋਗੇ ਤਾਂ ਜੀ ਅੱਛਾ ਠੀਕ ਹੈ ਠੀਕ ਹੈ ਜੀ ਮਤਲਬ ਤੁਸੀਂ ਹੋਰ ਵੀ ਸੂਟ ਸੀਊਂਣੇ ਤਾਂ ਸਾਨੂੰ ਦੱਸ ਦਿਓ

ਅੱਛਾ ਅੱਛਾ ਅੱਛਾ ਠੀਕ ਹੈ ਜੀ ਨਹੀਂ ਅਸੀਂ ਤਾਂ ਸਿੰਪਲ ਸੀਊਂਦੇ ਹਾਂ ਜੀ ਹਾਂ ਹਾਂਜੀ ਅਤੇ ਆਖਿਆ ਅਤੇ ਉਹਦੇ ਆਪਾਂ ਗੁੜੀਆ ਦੇ ਵੀ ਆਪਾਂ ਉਹ ਵੀ ਸੀਊਂ ਦੇਵਾਂਗੇ ਹਾਂਜੀ ਸੀਊਂ ਦੇਵਾਂਗੇ ਜੀ ਹਾਂਜੀ ਸੀਊਂ ਦੇਵਾਂਗੇ ਜੀ ਉਹਨਾਂ ਦੇ ਮਨ ਪਸੰਦ ਦੇ ਸੀਊਂ ਦੇਵਾਂਗੇ ਜਿਵੇਂ ਉਹ ਆਖਣਗੇ ਗੁੜੀਆ ਤੁਹਾਡੀ

ਹਾਂਜੀ ਹਾਂਜੀ ਲਿਆ ਦਿਓ ਜੀ ਭਲਾ ਗੁੜੀਆ ਨੂੰ ਨਾਲ ਲੈ ਆਓ ਜਿਸ ਤਰ੍ਹਾਂ ਦੇ ਗੁੜੀਆ ਆਖਣਗੇ ਆਪਾਂ

ਕੱਲ੍ਹ ਜਦੋਂ ਤੁਸੀਂ ਸੂਟ ਦੇਣ ਆਓਗੇ ਨਾ ਉਦੋਂ ਦੱਸ ਦੇਵਾਂਗੇ ਹਾਂਜੀ ਹਾਂਜੀ ਤੁਸੀਂ ਨਾਪ ਨਾਪ ਜੇ ਤੁਸੀਂ ਆਪਣਾ ਦੇਣਾ ਆਪਣਾ ਦੇ ਦਿਓ ਜੇ ਨਾਪ ਆਲਾ ਸੂਟ ਲਿਆਣਾ ਤਾਂ ਉਹ ਲੈ ਆਇਓ ਠੀਕ ਹੈ ਜੀ ਨਾਪ ਹਾਂਜੀ ਤੁਸੀਂ ਸਵੇਰੇ ਆ ਜਾਓ ਦਸ ਗਿਆਰਾਂ ਵਜੇ ਹਾਂ ਨਹੀਂ ਨਹੀਂ ਨਹੀਂ ਤੁਸੀਂ ਟਾਇਮ ਨਾਲ ਆ ਜਾਇਓ ਮੈਂ ਟਾਈਮ ਨਾਲ ਨਾਪ ਲੈ ਲਵਾਂਗੀ ਤੁਹਾਡਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਆਪਾਂ ਜਦੋਂ ਤੁਸੀਂ ਆਓਗੇ ਨਾ ਆਪਾਂ ਤੁਹਾਡਾ ਨਾਪ ਉਦੋਂ ਲੈ ਲਵਾਂਗੇ ਹਰ ਤਰ੍ਹਾਂ ਦੀ ਸੀਊਂ ਲੈਂਦੇ ਆ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਲੈ ਆਇਓ ਜੀ ਗੁੜੀਆ ਨੂੰ ਨਾਲ ਟਾਇਮ ਨਾਲ ਆਇਆ ਜੇ ਅੱਛਾ ਜੀ ਹਾਂਜੀ ਤੁਹਾਨੂੰ ਮੈਂ ਦੱਸ ਤਾ ਜੀ ਟਾਈਮ ਨਾ ਆਇਓ ਦੱਸ ਕੁ ਵਜੇ ਆ ਜਾਇਓ ਹਾਂ ਹਾਂਜੀ ਕੱਲ੍ਹ ਆ ਜਾਣਾ ਹੋਰ ਵੀ ਜੇ ਸੂਟ ਸਿਲਾਉਣੇ ਹੋਏ ਨਾ ਹੋਰ ਵੀ ਲੈ ਆਉਣਾ ਦੱਸ ਦੇਣਾ ਮੈਨੂੰ ਪਹਿਲਾਂ ਦੱਸ ਦੇਣਾ ਅੱਛਾ ਜੀ ਨਹੀਂ ਨਾ ਆਪਾਂ ਜਾ ਤੁਸੀਂ ਜਦੋਂ ਆਓਗੇ ਨਾ ਮੇਰੇ ਕੋਲ ਤੁਸੀਂ ਆਪਦੇ ਸੂਟ ਵੇਖਿਆ ਜੀ ਸੀਤੇ ਆਪਾਂ ਉਦੋਂ ਕਰ ਲਵਾਂਗੇ ਹਾਂ ਹਾਂਜਂੀ ਹਾਂਜੀ ਹਾਂਜੀ ਤੁਸੀਂ ਦੇਖੋਗੇ ਨਾ ਮੇਰੇ ਕੱਪੜੇ ਸੀਤੇ ਤੁਸੀਂ ਆਓਗੇ ਹੋਰ ਵੀ ਕਿਸੇ ਨੂੰ ਨਾਲ ਲੈ ਕੇ ਆਇਆ ਆਉਣਾ

ਹਾਂ ਹਾਂ ਹੈ ਜੀ ਤੁਸੀਂ ਆਪਦੇ ਮਨ ਪਸੰਦ ਦੀ ਲੈ ਕੇ ਆਉਣਾ ਹਾਂਜੀ ਉਹ ਤੁਹਾਡੀ ਮਨ ਪਸੰਦ ਹੈ ਠੀਕ ਹੈ ਜਿਸ ਤਰ੍ਹਾਂ ਤੁਸੀਂ ਆਖੋਗੇ ਮੈਂ ਉਸ ਤਰ੍ਹਾਂ ਦੀ ਲਾ ਦੇਵਾਂਗੀ ਭਾਵੇਂ ਤਿੰਨ ਲਵਾ ਲਓ ਉਹ ਤੁਹਾਡੀ ਮਰਜ਼ੀ ਆਪਾਂ ਲੈਸ ਵੀ ਲਾ ਦੇਵਾਂਗੇ ਪਾਈਪਿੰਗ ਵੀ ਲਾ ਦੇਵਾਂਗੇ ਜੇ ਤੁਸੀਂ ਆ ਕੇ ਦੇਖੋਗੇ ਨਾ ਆਪਾਂ ਉਹ ਉਹ ਜਿਹਾ ਕੰਮ ਹੀ ਕਰ ਦੇਵਾਂਗੇ ਤੁਹਾਡਾ ਹਾਂਜੀ ਠੀਕ ਆ ਜੀ ਠੀਕ ਆ ਜੀ ਧੰਨਵਾਦ ਜੀ